ਹਾਂ ਸਾਨੂੰ ਸਾਡੇ ਖੇਤਰ ਵਿੱਚ ਜਿਹੜਾ ਮਤਲਬ ਬਜ਼ਾਰ ਸਾਡੇ ਲਾਗੇ ਲੱਗਦਾ ਉਹ ਸੋਮ ਬਜ਼ਾਰ ਪੈਂਦਾ ਵਾ ਬਾਕੀ ਸਾਰੇ ਬਜ਼ਾਰਾਂ ਨਾਲੋਂ ਜਿਹੜਾ ਵਾ ਕਿ ਇੱਥੇ ਜਿਹੜਾ ਵਾ ਸਮਾਨ ਸਸਤਾ ਮਿਲਦਾ ਜਿਵੇਂ ਕਿ ਔਰਤਾਂ ਆਪਾਂ ਆਮ ਹੀ ਜਾਣਦੇ ਕਿ ਕੱਪੜੇ ਬਣਾਉਣ ਦੀਆਂ ਸ਼ੌਕੀਨ ਹੁੰਦੀਆਂ ਵਾ ਤਾਂ ਉਹ ਸੋਮਵਾਰ ਸੋਮ ਬਜ਼ਾਰ ਜਾਂਦੀਆਂ ਵਾਂ ਅਤੇ ਉਥੋਂ ਆਪਣੀ ਮਨਪਸੰਦ ਦਾ ਕੱਪੜਾ ਖਰੀਦ ਦੀਆਂ ਵਾ ਅਤੇ ਪੈਸੇ ਵੀ ਜਿਹੜੇ ਆ ਉਹ ਉਹਨਾਂ ਨੂੰ ਵੀ ਘੱਟ ਰੇਟ 'ਤੇ ਹੀ ਸੂਟ ਮਿਲ ਜਾਂਦਾ ਵਾ ਦੂਜੀ ਗੱਲ ਇਹ ਕਿ ਜਿਵੇਂ ਪਿੰਡਾਂ ਵਿੱਚ ਸਬਜ਼ੀ ਆਪਾਂ ਕਿਸੇ ਸਬ ਸਬਜ਼ੀ ਵੇਚਣ ਵਾਲੇ ਆਉਂਦੇ ਉਹਨਾਂ ਤੋਂ ਖਰੀਦਦੇ ਹਾਂ ਅਤੇ ਉਹ ਸਾਨੂੰ ਜ਼ਿਆਦਾ ਰੇਟ 'ਤੇ ਸਬਜ਼ੀ ਦਿੰਦੇ ਆ ਅਤੇ ਆਪਾਂ ਸਸਤੀਆਂ ਸਬਜ਼ੀਆਂ ਖਰੀਦਣ ਦੇ ਲਈ ਕੀ ਆ ਸਬਜ਼ੀ ਮੰਡੀ ਜਾਂਦੇ ਹਾਂ ਅਤੇ ਸਾਨੂੰ ਜਿਹੜੀ ਵੀ ਜਿਵੇਂ ਕਿ ਆਪਣੇ ਲਾਗੇ ਪੀਵੱਲੇ ਮੰਡੀ ਆਪਾਂ ਜਾਂਦੇ ਉੱਥੋਂ ਆਪਾਂ ਆਪਣੀ ਮਨਪਸੰਦ ਸਬਜ਼ੀ ਵੀ ਖਰੀਦ ਲੈਂਦੇ ਹਾਂ ਅਤੇ ਸਾਨੂੰ ਸਸਤੀ ਮਿਲ ਜਾਂਦੀ ਆ ਦੂਜੀ ਗੱਲ ਇਹ ਕਿ ਮਤਲਬ ਇੱਥੇ ਹਾਂ ਇਹ ਆਪਾਂ ਵੀ ਜਾ ਸਕਦੇ ਹਾਂ ਅਤੇ ਜਿਹੜੇ ਸੈਲਾਨੀ ਘੁੰਮਣ ਫਿਰਨ ਵਾਸਤੇ ਆਉਂਦੇ ਆ ਉਹ ਵੀ ਇਹਨਾਂ ਸਥਾਨ ਜਗ੍ਹਾ 'ਤੇ ਜਾ ਕੇ ਆਪਣੀ ਪਸੰਦ ਦੀਆਂ ਚੀਜ਼ਾਂ ਜਿਹੜੀਆਂ ਵਾ ਉਹ ਖਰੀਦ ਸਕਦੇ ਆ ਸੋਮ ਬਜ਼ਾਰ ਜਿਹੜਾ ਵਾ ਜਿਵੇਂ ਕਿ ਦੂਜੇ ਕਟੜਾ ਜੈਮਲ ਸਿੰਘ ਜਿਵੇਂ ਹੋਰ ਆਪਾਂ ਨੂੰ ਲਾਗੇ ਸ਼ ਸ਼ਹਿਰ ਲੱਗਦੇ ਆ ਉਹ ਬਹੁਤ ਜ਼ਿਆਦਾ ਮਹਿੰਗੇ ਆ ਅਤੇ ਇਹ ਜਿਹੜੇ ਬਜ਼ਾਰ ਆ ਸਸਤੇ ਆ ਅਤੇ ਇਹਨਾਂ ਦੇ ਇਹਨਾਂ ਵਿੱਚ ਆਪਾਂ ਜਿਹੜਾ ਵਾ ਵੀ ਆਪਣਾ ਸਮਾਨ ਜਿਹੜਾ ਵਾ ਉਹ ਘੱਟ ਸਸਤਾ ਖਰੀਦ ਸਕਦੇ ਹਾਂ ਦੂਜੇ ਬਜ਼ਾਰਾਂ ਨਾਲੋਂ ਇਹ ਬਜ਼ਾਰਾਂ ਦਾ ਸਾਨੂੰ ਫਾਇਦਾ ਵਾ ਅਤੇ ਸਸਤਾ ਖਰੀਦਿਆ ਜਾਂਦਾ ਸਮਾਨ